ਹਾਂ ਮੈਂ ਆਪਣੇ ਨਾਲ ਦੇ ਸਾਥੀਆਂ ਜੋ ਕਿ ਫੌਜ ਦੇ ਵਿੱਚ ਸਨ ਉਹਨਾਂ ਨਾਲ ਦੌੜਦਾ ਹੁੰਦਾ ਸੀ ਸੁਬਾਹ ਦੇ ਟਾਈਮ ਅਸੀਂ ਤਕਰੀਬਨ ਪੰਜ ਵਜੇ ਦੌੜਦੇ ਸੀ ਔਰ ਇੱਕ ਘੰਟਾ ਲਗਾਤਾਰ ਅੱਧਾ ਘੰਟਾ ਦੌੜਨਾ ਉਸ ਤੋਂ ਬਾਅਦ ਕਸਰਤ ਕਰਨੀ ਮੈਨੂੰ ਆਪਣੇ ਗਰੁੱਪ ਵਿੱਚ ਰਹਿ ਕੇ ਬਹੁਤ ਵਧੀਆ ਲੱਗਦਾ ਸੀਗਾ ਅਤੇ ਅਸੀਂ ਆਪਸ ਵਿੱਚ ਗੱਲਾਂ ਬਾਤਾਂ ਮਾਰ ਕੇ ਆਪਣਾ ਵਧੀਆ ਟਾਈਮ ਕੱਢਦੇ ਸੀ ਔਰ ਸਰੀਰ ਨੂੰ ਫਿੱਟ ਕਰਦੇ ਸੀ